ਹੈਲੋ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਅਰੁਣਾ ਹੈ ਸਾਡਾ ਨਾ ਪੰਜਾਬ ਜਿਹੜਾ ਮੈਦਾਨੀ ਇਲਾਕਾ ਹੀ ਹੈ ਵੈਸੇ ਤਾਂ ਫੇਰ ਇੱਥੇ ਉਹ ਬੀਚ ਘੱਟ ਹੀ ਹੈ ਦਰਿਆ ਅਤੇ ਨਹਿਰਾਂ ਹੀ ਆ ਜ਼ਿਆਦਾ ਇੱਥੇ ਇੱਥੇ ਆਉਂਦੇ ਆ ਲੋਕ ਦੂਰੋਂ ਦੂਰੋਂ ਆਣ ਕੇ ਘੁੰਮਦੇ ਹੈ ਅਤੇ ਉਹ ਪਾਣੀ ਵਿੱਚ ਬੱਚੇ ਖੇਡਦੇ ਆ ਅਤੇ ਬੁੱਢੇ ਅਤੇ ਜਵਾਨ ਨਹਾਉਂਦੇ ਵੀ ਆ ਉੱਥੇ ਬੜੇ ਖੁਸ਼ ਹੁੰਦੇ ਆ ਇੱਥੇ ਅਤੇ ਬੀਚ ਤਾਂ ਬਸ ਇੱਕ ਜਲੰਧਰ ਆ ਅਤੇ ਇੱਕ ਲੁਧਿਆਣੇ ਹੈ ਉੱਥੋਂ ਵੀ ਬੜੇ ਲੋਕ ਦੁਨੀਆ ਬਾਹਰੋਂ ਵੀ ਆਉਂਦੀ ਹੈ ਉੱਥੇ ਆਪਣਾ ਉਹ ਕਰਦੇ ਹੈ ਮਨੋਰੰਜਨ ਕਰਦੇ ਹੈ ਨਹਾਉਂਦੇ ਧੋਂਦੇ ਆ ਉੱਥੇ ਖੇਡਦੇ ਹੈ ਬਹੁਤ ਆ ਜਾ ਕੇ ਖੁਸ਼ ਹੁੰਦੇ ਆ ਉੱਥੇ ਆ ਕੇ ਅਤੇ ਇਹ ਵਾ ਸਾਡਾ ਹੈ ਮੈਦਾਨੀ ਇਲਾਕਾ ਹੀ ਹੈ ਬਸ ਅਤੇ ਹੋਰ ਜ਼ਿਆਦਾ ਦੂਰੋਂ ਦੂਰੋਂ ਆ ਕੇ ਅਤੇ ਇੱਥੇ ਉਹ ਕਰਦੇ ਹੈ ਅਤੇ ਇਹਨਾਂ ਦਾ ਇਹ ਵਾ ਵੀ ਚਲੋ ਬੱਚੇ ਆਣ ਕੇ ਖੁਸ਼ ਹੋ ਜਾਂਦੇ ਹੈ ਚ ਸਿਆਣੇ ਵੀ ਖੁਸ਼ ਹੋ ਜਾਂਦੇ ਹੈ ਅਤੇ ਬੁੱਢੇ ਜ਼ਿਆਦਾ ਹੋ ਜਾਂਦੇ ਹੈ ਉਹ ਵੀ ਆ ਕੇ ਪਾਣੀ ਦੇ ਵਿੱਚ ਉਹ ਜਿਹੜੀ ਉਹ ਉਹ ਕਿਸ਼ਤੀਆਂ ਹੁੰਦੀਆਂ ਉਹਨਾਂ 'ਚ ਆਣ ਕੇ ਉਹ ਕਿੱਦਾਂ ਨਹੀਂ ਪਾਣੀ ਵਿੱਚ ਕਰਦੇ ਆ ਮਨੋਰੰਜਨ ਕਰਦੇ ਆਪਣਾ ਬਹੁਤ ਜ਼ਿਆਦਾ ਖੁਸ਼ ਹੁੰਦੇ ਹੈ ਆ ਕੇ ਖੁੱਲ੍ਹੀ ਜਗ੍ਹਾ ਦੇ ਵਿੱਚ ਆ ਕੇ ਬਹੁਤ ਜ਼ਿਆਦਾ ਬਹਿੰਦੇ ਖਲੋਂਦੇ ਆਣ ਕੇ ਅਤੇ ਉਹ ਕਰਦੇ ਆ ਕਿੰਨਾ ਨਹੀਂ ਅਤੇ ਉਹਨਾਂ ਦਾ ਇਹ ਵਾ ਵੀ ਚਲੋ ਦੁਨੀਆ ਦੂਰੋਂ ਦੂਰੋਂ ਤੱਕ ਆਉਂਦੇ ਹੈ ਅਸੀਂ ਵੀ ਖੁਸ਼ ਹਾਂ ਅਸੀਂ ਵੀ ਜਾਂਦੇ ਆਉਂਦੇ ਹਾਂ ਅਸੀਂ ਵੀ ਉੱਥੇ ਘੁੰਮ ਫਿਰ ਆਉਂਦੇ ਹਾਂ ਅਤੇ ਚਲੋ ਖੁਸ਼ ਹੋ ਜਾਂਦਾ ਮਨ ਕਿੰਨਾ ਨਹੀਂ ਦੇਖ ਦੂਖ ਕੇ ਨਹਿਰਾਂ ਨੂਹਰਾਂ ਦੇਖ ਕੇ ਦਰਿਆ ਦੇਖ ਕੇ ਸਾਰਾ ਕਿੱਦਾਂ ਨਹੀਂ ਕ ਬੀਚ ਬੀਚ ਵੀ ਜਾਂਦੇ ਹਾਂ ਅਸੀਂ ਉੱਥੇ ਵੀ ਘੁੰਮ ਫਿਰ ਕੇ ਆਉਂਦੇ ਹਾਂ ਅਤੇ ਚਲੋ ਇਹ ਹੋ ਜਾਂਦਾ ਠੀਕ ਹੋ ਜਾਂਦਾ ਚਲੋ ਬੱਚੇ ਖੁਸ਼ ਹੋ ਜਾਂਦੇ ਹੈ